ਵਿਕਾਸਸ਼ੀਲ ਸੰਸਾਰ ਦਾ ਮਤਲਬ ਹੈ ਕਿ ਅਸੀਂ ਵਿਕਸਿਤ ਹਾਂ ਜਿੱਥੇ ਕਿ ਸ਼੍ਰੇਣੀਆਂ ਬਹੁਤ ਘੱਟ ਗਈਆਂ ਜਿੱਥੇ ਕਿ ਗਰੀਬ ਜ਼ਿਆਦਾ ਗਰੀਬ ਨਹੀਂ ਹੈਗਾ ਅਮੀਰ ਬਹੁਤ ਜ਼ਿਆਦਾ ਅਮੀਰ ਨਹੀਂ ਹੈਗਾ ਜਿੱਥੇ ਕਿ ਸਮਾਨਤਾ ਹੈ ਔਰ ਹ ਸਭ ਤੋਂ ਜ਼ਿਆਦਾ ਹਰ ਜਿਹੜਾ ਬੰਦਾ ਹੈ ਉਹ ਢਿੱਡ ਭਰ ਕੇ ਸੌਂਦਾ ਹੈ ਜਿਹਦੇ ਵਿੱਚ ਕਿ ਜਿਹੜੇ ਆਧੁਨਿਕਤਾ ਦੇ ਨਾਲ ਆਧੁਨਿਕਤਾ ਦੀ ਮਦਦ ਦੇ ਨਾਲ ਜਿਹੜੇ ਜੀਵਨਸ਼ੈਲੀ ਹੈ ਉਸਨੂੰ ਹੋਰ ਸੁਖਾਲਾ ਬਣਾਇਆ ਗਿਆ ਹੈ ਅਤੇ ਉਹਦੇ ਨਾਲ ਹੀ ਰੁਜ਼ਗਾਰ ਅ ਦਿੱਤੇ ਗਏ ਹਨ ਅਤੇ ਇਸ ਤੋਂ ਇਲਾਵਾ ਜਿਹੜੇ ਸਾਇੰਸ ਦਾ ਖੇਤਰ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ ਸੋ ਵਿਕਾਸਸ਼ੀਲ ਸੰਸਾਰ ਹੈ ਜਿਹੜਾ ਕਿ ਵਿਕਸਿਤ ਹੈ ਜਿਹਦੇ ਵਿੱਚ ਕਿ ਦੇਸ਼ ਤਰੱਕੀ ਤਾਂ ਕਰ ਰਿਹਾ ਹੈ ਨਾਲ ਦੀ ਨਾਲ ਜਿਹੜੇ ਮ ਉਥੋਂ ਦੀ ਜਨਤਾ ਹੈ ਉਹ ਵੀ ਬਹੁਤ ਸੌਖਾ ਜੀਵਨ ਬਤੀਤ ਕਰਦੀ ਹੈ ਦੁਨੀਆ ਬਹੁਤ ਬਦਲ ਗਈ ਹੈ ਅਸੀਂ ਖੁਦ ਆਪਣੇ ਅੱਖੀਂ ਦੇਖਿਆ ਹੈ ਕਿ ਜਦੋਂ ਅਸੀਂ ਛੋਟੇ ਸੀ ਤਾਂ ਜਿਹੜੀ ਟੈਲੀਵਿਜ਼ਨ ਜਿਹੜੇ ਸੀਗੇ ਇੱਕ ਲੱਕੜੀ ਦੇ ਬਕਸੇ ਵਿੱਚ ਬੰਦ ਹੁੰਦੇ ਸਨ ਅਤੇ ਅੰਟੀਨੇ ਹੁੰਦੇ ਸਨ ਅੱਜ ਆਉਂਦੇ ਆਉਂਦੇ ਦੇਖ ਲਉ ਵੀ ਅਸੀਂ ਐੱਲ ਸੀ ਡੀਜ਼ ਜਿਹੜੀਆਂ ਹੈਗੀਆਂ ਹੈ ਉਹ ਦੇਖੀਆਂ ਹਨ ਫੋਨ ਜਿਹੜੇ ਹੈਗੇ ਹੈ ਪਹਿਲਾਂ ਸਾਡੇ ਅਸੀਂ ਲੈਂਡਲਾਈਨ ਫੋਨ ਵਰਤਦੇ ਸੀਗੇ ਉਸ ਤੋਂ ਬਾਅਦ ਕੋਡਲੈਸ ਆ ਗਏ ਉਸ ਤੋਂ ਬਾਅਦ ਫਿਰ ਤਰੱਕੀ ਹੁੰਦੇ ਹੁੰਦੇ ਵਿਕਾਸ ਹੁੰਦੇ ਹੁੰਦੇ ਅੱਜ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹਨ ਜੋ ਕਿ ਸਾਰਾ ਇਹ ਜਿਹੜੀ ਹੈਗੀ ਹੈ ਦੁਨੀਆਂ ਜਿਹੜੀ ਹੈ ਉਹ ਪੂਰੀ ਤਰ੍ਹਾਂ ਬਦਲ ਗਈ ਹੈ ਉਸਦੇ ਨਾਲ ਹੀ ਲੋਕਾਂ ਦੀ ਜੀਵਨਸ਼ੈਲੀ 'ਤੇ ਵੀ ਬਹੁਤ ਅਸਰ ਪਿਆ ਹੈ ਉਹਨਾਂ ਦੀਆਂ ਜਿਹੜੀਆਂ ਆਦਤਾਂ ਹਨ ਉਹਨਾਂ ਦੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਨਾਂ 'ਤੇ ਵੀ ਗਹਿਰਾ ਅਸਰ ਪਿਆ ਹੈ